ਸਤਿ ਸ਼੍ਰੀ ਅਕਾਲ ਜੀ ਪੰਜਾਬ ਵਿੱਚ ਉਦਾਂ ਤਾਂ ਬਹੁਤ ਪ੍ਰਮੁੱਖ ਸੰਗੀਤ ਹਨ ਪਰ ਮੈਂ ਕੁਝ ਕੁ ਸੰਗੀਤਾਂ ਦੀ ਗੱਲ ਕਰਨਾ ਚਾਹਾਂਗੀ ਜਿਵੇਂ ਕਿ ਬਿੰਦਰਖੀਏ ਦਾ ਸੰਗੀਤ ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ ਤੇਰੇ 'ਚ ਤੇਰਾ ਯਾਰ ਬੋਲਦਾ ਜੋ ਕਿ ਉਹ ਇਸ ਸਮੇਂ ਸਾਡੇ ਵਿੱਚ ਨਹੀਂ ਰਹੇ ਪਰ ਲੋਕ ਉਹਨਾਂ ਦਾ ਇਹ ਗਾਣਾ ਬਹੁਤ ਪਸੰਦ ਕਰਦੇ ਜਿਵੇਂ ਕਿ ਆਮ ਵਿਆਹਾਂ ਸ਼ਾਦੀਆਂ 'ਤੇ ਇਹ ਗਾਣਾ ਲਗਾਇਆ ਜਾਂਦਾ ਹੈ ਮੈਂ ਪੰਜਾਬ ਦੀ ਰਹਿਣ ਵਾਲੀ ਹਾਂ ਪੰਜਾਬ ਜਿਵੇਂ ਕਿ ਤੁਹਾਨੂੰ ਪਤਾ ਹੈ ਬਹੁਤ ਗੁਰੂਆਂ ਪੀਰਾਂ ਦੀ ਧਰਤੀ ਹੈ ਅਤੇ ਜਿਵੇਂ ਗੱਲ ਕੀਤੀ ਜਾਵੇ ਭੰਗੜੇ ਅਤੇ ਗਿੱਧੇ ਦੀ ਭੰਗੜਾ ਪਾਉਣਾ ਮੈਂ ਬਹੁਤ ਵਧੀਆ ਪਸੰਦ ਕਰਦੀ ਹਾਂ ਭੰਗੜੇ ਨਾਲ ਇੱਕ ਤਾਂ ਸਾਡੇ ਸਰੀਰ ਦੀ ਵਰਜਿਸ਼ ਹੁੰਦੀ ਹੈ ਲੇਕਿਨ ਭੰਗੜਾ ਪਾਉਣ ਨਾਲ ਸਾਡਾ ਸਰੀਰ ਫਿੱਟ ਰਹਿੰਦਾ ਹੈ ਭੰਗੜਾ ਪਾਉਣ ਨਾਲ ਸਾਡੇ ਸਰੀਰ ਦੀ ਵਰਜਿਸ਼ ਹੁੰਦੀ ਹੈ ਅਤੇ ਭੰਗੜਾ ਪਾਉਣਾ ਮੈਨੂੰ ਬੜਾ ਵਧੀਆ ਵੀ ਲੱਗਦਾ ਹੈ ਗਿੱਧਾ ਗਿੱਧਾ ਵੀ ਪਾਉਣਾ ਮੈਂ ਬਹੁਤ ਪਸੰਦ ਕਰਦੀ ਹਾਂ ਫਿਰ ਜਿਵੇਂ ਗੱਲ ਕੀਤੀ ਜਾਵੇ ਤਿਉਹਾਰਾਂ ਦੀ ਸਾਡੇ ਜਿਹੜੇ ਤਿਉਹਾਰ ਨੇ ਉਹ ਵੀ ਗੀਤਾਂ ਰਾਹੀਂ ਹੀ ਮੰਨੇ ਜਾਂਦੇ ਨੇ ਜਿਵੇਂ ਕਿ ਅਸੀਂ ਲੋਹੜੀ ਲੋਹੜੀ ਵੀ ਅਸੀਂ ਗੀਤ ਗਾ ਕੇ ਮੰਗਦੇ ਹਾਂ ਜਿਵੇਂ ਕਿ ਸੁੰਦਰ ਮੁੰਦਰੀਏ ਹੋਏ ਤੇਰਾ ਕੌਣ ਵਿਚਾਰਾ ਹੋਏ ਦੁੱਲਾ ਭੱਟੀ ਵਾਲਾ ਹੋਏ ਦੁੱਲੇ ਦੀ ਧੀ ਵਿਆਹੀ ਜਿਵੇਂ ਕਿ ਹੋਏ ਨਾਂ ਦਾ ਲਫਜ਼ ਸੁਣ ਕੇ ਤੁਹਾਡੇ ਆਪਦੇ ਮੋਢੇ ਨੱਚਣ ਲੱਗ ਪੈਣਗੇ ਮੈਂ ਵੀ ਖੁਦ ਨੱਚਣ ਲੱਗ ਪਈ ਹਾਂ ਅਤੇ ਪੰਜਾਬ ਵਿੱਚ ਲੋਹੜੀ ਨੂੰ ਵੀ ਗੀਤ ਗਾ ਕੇ ਹੀ ਤਿਉਹਾਰਾਂ ਦੇ ਨਾਲ ਮਨਾਇਆ ਜਾਂਦਾ ਹੈ ਅਤੇ